ਹੈਲੋ ਸਤਿ ਸ਼੍ਰੀ ਅਕਾਲ ਸਰ ਅਨੇਜਾ ਸਵੀਟਸ ਸਰ ਅਸੀਂ ਕੱਲ੍ਹ ਤੁਹਾਡੀ ਸ਼ੋਪ ਤੋਂ ਨਾ ਫੂਡ ਔਡਰ ਕੀਤਾ ਸੀ ਬਟ ਉਹਦੀ ਕੁਆਲਿਟੀ ਬਿਲਕੁਲ ਅੱਛੀ ਨਹੀਂ ਸੀ ਬਹੁਤ ਜ਼ਿਆਦਾ ਬਾਸੀ ਸੀ ਸਪਾ ਸਪਾਇਸੀ ਸੀ ਤਾਂ ਅਸੀਂ ਬਹੁਤ ਵਾਰੀ ਔਡਰ ਕਰਦੇ ਹਾਂ ਬਟ ਇਸ ਵਾਰ ਤਾਂ ਬਿਲ ਪੈਕਿੰਗ ਵੀ ਨਹੀਂ ਅੱਛੀ ਸੀ ਇੰਨੇ ਜ਼ਿਆਦਾ ਮਿਰਚ ਮਸਾਲੇ ਪਾਏ ਹੋਏ ਸੀ ਸਾਡੇ ਗੈਸਟ ਆਏ ਹੋਏ ਸੀ ਉਹ ਕਹਿੰਦੇ ਕਿਹੜੀ ਸ਼ੋਪ ਤੋਂ ਔਡਰ ਕੀਤਾ ਸਰ ਕੁਛ ਤਾਂ ਕੁਆਲਿਟੀ ਦਿਉ ਨਾ ਤਾਂ ਹੀ ਬੰਦਾ ਤੁਹਾਨੂੰ ਕੁਛ ਕੁਛ ਨਾ ਕੁਛ ਫੂਡ ਔਡਰ ਕਰੇਗਾ ਤਾਂ ਇਹ ਤਾਂ ਬਿਲਕੁਲ ਅੱਛਾ ਨਹੀਂ ਹੈਗਾ ਤੁਸੀਂ ਆਪਣੇ ਮੈਨੇਜਰ ਨੂੰ ਕਰਕੇ ਫੋਨ ਕਰਕੇ ਜਾਂ ਗੱਲ ਕਰਕੇ ਸਾਡੇ ਪੈਸੇ ਰਿਫੰਡ ਕਰੋ ਅਸੀਂ ਹਰ ਵਾਰੀ ਤੁਹਾਡੇ ਤੋਂ ਔਡਰ ਕਰਦੇ ਹਾਂ ਇਸ ਵਾਰ ਤੁਹਾਡੇ ਨਾਲ ਇਹੋ ਜਿਹਾ ਕੀ ਕੀਤਾ ਸਰ ਨਹੀਂ ਸਾਡੀ ਪੇਮੈਂਟ ਬਾਅਦ 'ਚ ਵਾਪਸ ਕਰੋ